ਹਾਂਜੀ ਆਮ ਤੌਰ 'ਤੇ ਮੈਂ ਪੈੱਨ ਨਾਲ ਕਾਗਜ਼ 'ਤੇ ਲਿਖਣਾ ਹੀ ਪਸੰਦ ਕਰਦਾ ਹਾਂ ਕਿਉਂਕਿ ਇਸ ਤਰ੍ਹਾਂ ਲਿਖਣ ਨਾਲ ਇੱਕ ਤਾਂ ਆਪਣੀ ਰਾਈਟਿੰਗ ਵਿੱਚ ਸੁਧਾਰ ਆਉਂਦਾ ਹੈ ਅਤੇ ਇੱਕ ਤਰ੍ਹਾਂ ਨਾਲ ਆਪਾਂ ਨੂੰ ਲਿਖਣ ਦੇ ਵਿੱਚ ਮਦਦ ਮਿਲਦੀ ਹੈ ਅਤੇ ਆਪਣੀ ਨੌਲੇਜ ਜ਼ਿਆਦਾ ਵੱਧਦੀ ਹੈ ਕਿਉਂਕਿ ਲਿਖਣ ਨਾਲ ਹੀ ਬੰਦੇ ਦੇ ਬੰਦੇ ਪਤਾ ਲੱਗਦਾ ਹੈ ਕਿ ਉਸਨੇ ਕੀ ਕੀ ਲਿਖਿਆ ਅਤੇ ਉਸ ਦੇ ਵਿੱਚ ਕੀ ਗਲਤੀਆਂ ਹਨ ਪਰ ਅੱਜ ਦੇ ਯੁੱਗ ਵਿੱਚ ਲੈਪਟੋਪ ਮੋਬਾਈਲ ਅਤੇ ਅ ਵਗੈਰਾ ਆ ਚੁੱਕੇ ਹਨ ਜਿਨ੍ਹਾਂ ਵਿੱਚ ਅਸੀਂ ਟਾਈਪ ਕਰਦੇ ਹਾਂ ਅਤੇ ਜੋ ਟਾਈਪ ਕਰਦੇ ਹਾਂ ਜੇ ਕੁਛ ਗਲਤ ਵੀ ਹੁੰਦਾ ਤਾਂ ਉਹ ਆਪਣੇ ਆਪ ਹੀ ਸਹੀ ਸ਼ੋ ਹੋ ਜਾਂਦਾ ਹੈ ਇਸ ਲਈ ਨਾਲ ਅੱ ਅੱਜ ਦੇ ਯੁੱਗ ਵਿੱਚ ਲਿਖਣ ਸਾਲਾਂ ਵਿੱਚ ਲਿਖਣਾ ਬਦਲਿਆ ਗਿਆ ਹੈ ਲਿਖਣ ਨਾਲ ਹੀ ਟਾਈਪ ਲਿਖਣ ਨਾਲੋਂ ਅੱਜ ਕੱਲ ਟਾਈਪ ਜ਼ਿਆਦਾ ਚੱਲਣ ਲੱਗ ਗਿਆ ਹੈ ਲਿਖ ਟਾਈਪ ਨਾਲ ਹੀ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਟਾਈਪਿੰਗ ਸਪੀਡ ਕਿੰਨੀ ਵਧੀ ਹੈ ਪਹਿਲਾਂ ਅਸੀਂ ਕਾਗਜ਼ ਅਤੇ ਪੈੱਨ ਨਾਲ ਲਿਖਦੇ ਸੀਗੇ ਕਾ ਜਦੋਂ ਅਸੀਂ ਪੈੱਨ ਨਾਲ ਲਿਖਦੇ ਸੀ ਉਹ ਹੌਲੀ ਹੌਲੀ ਜਿਵੇਂ ਕੋਈ ਸਾਨੂੰ ਬੋਲਦਾ ਸੀ ਅਸੀਂ ਇੱਕ ਸ਼ਬਦ ਲਿਖਦੇ ਸੀ ਦੂਜਾ ਸ਼ਬਦ ਲਿਖਦੇ ਸੀ ਪਰ ਹੁਣ ਜਦੋਂ ਸ ਸਾਡੇ ਕੋਲ ਕੋਈ ਪੇਪਰ 'ਤੇ ਲਿਖੀ ਹੋਈ ਚੀਜ਼ ਪਈ ਹੁੰਦੀ ਆ ਅਸੀਂ ਉਸਨੂੰ ਮਿੰਟ 'ਚ ਟਾਈਪ ਕਰਕੇ ਅਗਲੇ ਦੇ ਸਾਹਮਣੇ ਰੱਖ ਦਿੰਦੇ ਹਾਂ ਪਰ ਪਹਿਲਾਂ ਅਜਿਹਾ ਕੁਛ ਨਹੀਂ ਸੀ ਸੋ ਅੱਜ ਦੇ ਸਮੇਂ ਵਿੱਚ ਕਾਫੀ ਬਦਲਾਅ ਆਇਆ ਹੈ ਲਿਖਣ ਦੇ ਵਿੱਚ